ਹੈਲੋ ਹਾਂਜੀ ਨਮਸਕਾਰ ਜੀ ਹਾਂਜੀ ਹਾਂਜੀ ਵਧੀਆ ਹਾਂਜੀ ਉਨ ਨਾ ਅੱਛਾ ਇਹ ਰੇਲਵੇ ਸਟੇਸ਼ਨ ਤੇ ਹੈਗੇ ਹੋ ਤੁਸੀਂ ਤਾਂ ਸਭ ਤੋਂ ਪਹਿਲਾਂ ਨਾ ਵੱਡਾ ਗੁਰਦੁਆਰਾ ਇੱਕ ਹੈਗਾ ਇਥੇ ਸਿੰਘ ਸਭਾ ਗਊਸ਼ਾਲਾ ਰੋਡ ਤੇ ਤੋਂਕ ਵੱਲ ਆਓਗੇ ਨਾ ਸ਼ਾਸਤਰੀ ਚੋਂਕ ਤੋਂ ਆ ਕੇ ਫਿਰ ਗਊਸ਼ਲਾ ਰੋਡ ਤੇ ਮੁੜ ਜਹੇ ਨਾਲ ਨਾਦਰ ਦਾ ਚੋਂਕ ਹੈਗਾ ਅੱਗੇ ਇਹ ਗਊਸ਼ਾਲਾ ਰੋਡ ਤੇ ਅੱਗੇ ਜਾ ਕੇ ਨਾ ਸਪੋਰਟ ਦਾ ਸ਼ੋਰੂਮ ਤੋਂ ਉਰੇ ਆ ਥੋੜਾ ਜਿਹਾ ਹੁਣੇ ਪਤਾ ਲੱਗ ਜਾਏਗਾ ਉਥੇ ਇਕ ਕਿਲੋਮੀਟਰ ਇੱਕ ਡੇਢ ਕਿਲੋਮੀਟਰ ਐ ਡੇਢ ਕ ਕਿਲੋਮੀਟਰ ਹੋਏਗਾ ਹਾਂਜੀ ਡੇਢ ਕ ਹੋਏ ਹਾਂ ਬਹੁਤ ਸੋਹਣਾ ਬਣਿਆ ਹੋਇਆ ਬੜਾ ਵਧੀਆ ਬਣਾਇਆ ਨਵਾਂ ਬਣਿਆ ਹਾਂ ਨਹੀਂ ਉਹ ਇਧਰ ਤਾ ਦਾ ਨੀ ਆਣਾਗਾ ਓ ਪਰੇ ਹਾਈ ਸਕੂਲ ਵਾਲੇ ਪਾਸੇ ਇੱਕ ਹੈਗਾ ਕੋਟ ਰੋਡ ਤੇ ਨਾ ਹੈਗਾ ਡੀ ਸੀ ਮੋਡ ਸਕੂਲ ਜਾਂ ਪਹਿਲਾਂ ਇਥੋਂ ਜਾਉਗੀ ਨਾ ਕਰੋਸ ਕਰੋਗੇ ਰੇਲਵੇ ਜਿਹੜਾ ਬ੍ਰਿਜ ਰੇਲਵੇ ਦਾ ਜਿਹੜੀ ਬਣੀ ਹੋਈ ਹ ਫਲਾਈ ਫਲਾਈ ਓਵਰ ਨੀ ਰੇਲਵੇ ਸਟੇਸ਼ਨ ਤੋਂ ਤੁਸੀਂ ਉਧਰ ਨੂੰ ਜਾਣਾ ਬੋਏ ਸਕੂਲ ਵਾਲੇ ਪਾਸੇ ਠੀਕ ਐ ਬੋਆਏ ਸਕੂਲ ਹਾਂ ਉਥੇ ਹੈਗਾ ਇੱਕ ਓਕੇ